ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਨੂੰ ਖਾਣਾ ਬਣਾਉਣ ਦਾ ਸ਼ੁਰੂ ਤੋਂ ਹੀ ਸ਼ੌਂਕ ਆ ਕਿਉਂਕਿ ਮੈਂ ਖਾਣਾ ਜਿਹੜਾ ਆਪਣੇ ਸ਼ੁਰੂ ਤੋਂ ਆਪਣੀ ਮੰਮ ਮਾਂ ਮੰਮੀ ਜੀ ਕੋਲੋਂ ਸਿੱਖਿਆ ਹੈ ਕਿਉਂਕਿ ਮੇਰੀ ਮਦਰ ਖਾਣਾ ਬਹੁਤ ਅੱਛਾ ਬਣਾਉਂਦੇ ਸਨ ਉਹਨਾਂ ਨੇ ਮੈਨੂੰ ਹਰ ਇੱਕ ਚੀਜ਼ ਬਣਾਉਣੀ ਸਿਖਾਈ ਜਿਸ ਤਰ੍ਹਾਂ ਕੜ੍ਹੀ ਚਾਵਲ ਰਾਜਮਾਂਹ ਚਾਵਲ ਸਾਗ ਸਰਸੋਂ ਦੀ ਰੋਟੀ ਕਿਉਂਕਿ ਜੋ ਸਾ ਜੋ ਫੇਮਸ ਆ ਸਭ ਉਹਨਾਂ ਨੇ ਸਭ ਕੁਛ ਮੈਨੂੰ ਸਿਖਾਇਆ ਹੈ ਜਿਹਨਾਂ ਦੇ ਵਿੱਚ ਮੈਂ ਬੈਂਗਣ ਦਾ ਭੜਥਾ ਬਹੁਤ ਅੱਛੇ ਤਰੀਕੇ ਨਾਲ ਬਣਾ ਲੈਂਦੀ ਆ ਜਿਸ ਤਰ੍ਹਾਂ ਲੋਕ ਬੈਂਗਣ ਨੂੰ ਸ ਸਾਬਤ ਭੁੰਨ ਲੈਂਦੇ ਹਨ ਮੈਂ ਇਸ ਤਰੀਕੇ ਨਾਲ ਨਹੀਂ ਬਣਾਉਂਦੀ ਮੈਂ ਸਭ ਤੋਂ ਪਹਿਲਾਂ ਕਿਉਂਕਿ ਕਈ ਵਾਰੀ ਬੈਂਗਣ ਖਰਾਬ ਵੀ ਹੁੰਦੇ ਹਨ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਬੈਂਗਣਾਂ ਨੂੰ ਸ ਕੱਟ ਕੇ ਉਹਨਾਂ ਨੂੰ ਸਾਫ ਕਰਕੇ ਧੋ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਉਬਾਲ ਕੇ ਉਹਨਾਂ ਨੂੰ ਮੈਸ਼ਰ ਦੇ ਨਾਲ ਮੈਸ਼ ਕਰਕੇ ਉਸ ਤੋਂ ਬਾਅਦ ਅਸੀਂ ਪਿਆਜ ਪਿਆਜ ਲਸਣ ਅਦਰਕ ਜੋ ਵੀ ਉਸਦਾ ਤੜਕਾ ਲਗਾ ਕੇ ਸਾਫ ਸੁਥਰੇ ਤਰੀਕੇ ਨਾਲ ਬਣਾਉਂਦੇ ਹਾਂ ਬਾਅਦ 'ਚ ਉਹਨਾਂ ਨੂੰ ਦਹੀਂ ਦੇ ਨਾਲ ਸਾਰੇ ਬੜਾ ਖੁਸ਼ ਹੋ ਕੇ ਖਾਂਦੇ ਹਨ